ਆਮ ਤੌਰ 'ਤੇ ਅਸੀਂ ਪੰਛੀਆਂ ਨੂੰ ਜਦੋਂ ਦੇਖਦੇ ਹਾਂ ਅਤੇ ਅਸੀਂ ਉਹਨਾਂ ਦਾ ਰੰਗ ਅਤੇ ਉਹਨਾਂ ਦਾ ਉੱਡਣ ਦਾ ਤਰੀਕਾ ਅਤੇ ਕੀ ਉਹਨਾਂ ਦਾ ਬਾਰੇ ਜਾਣ ਜਾਂਦੇ ਹਾਂ ਲੇਕਿਨ ਕਈ ਵਾਰ ਅਸੀਂ ਪੰਛੀਆਂ ਨੂੰ ਛੁੱਪ ਕੇ ਅਤੇ ਓਹਲੇ ਹੋ ਕੇ ਦੇਖਦੇ ਹਾਂ ਉਹਦੇ ਨਾਲ ਕਈ ਵਾਰ ਸਾਡੀਆਂ ਧਾਰਮਿਕ ਚੀਜ਼ਾਂ ਵੀ ਰਲੀਆਂ ਹੁੰਦੀਆਂ ਹਨ ਜਿੱਦਾਂ ਪੰਛੀ ਨੂੰ ਦੇਖਣਾ ਇੱਕ ਸ਼ੁਭ ਮੰਨਿਆ ਜਾਂਦਾ ਹੈ ਅਗਰ ਪੰਛੀ ਓਹਲੇ ਹੋ ਕੇ ਅਸੀਂ ਦੇਖਦੇ ਹਾਂ ਅਤੇ ਅਸੀਂ ਸੋਚਦੇ ਹਾਂ ਵੀ ਇਹ ਪੰਛੀ ਉਡੇਗਾ ਅਤੇ ਸਾਨੂੰ ਧਾਰਮਿਕ ਯਾਤਰਾ ਮਿਲੇਗੀ ਅਤੇ ਇਸ ਤਰ੍ਹਾਂ ਨਾਲ ਕਈ ਵਾਰ ਧਾਰਮਿਕ ਗੱਲਾਂ ਨਾਲ ਵੀ ਪੰਛੀਆਂ ਨੂੰ ਅਸੀਂ ਦੇਖਦੇ ਹਾਂ ਕਈ ਵਾਰ ਅਸੀਂ ਪੰਛੀਆਂ ਨੂੰ ਦਾਣਾ ਚੁਗਦੇ ਦੇਖਦੇ ਹਾਂ ਜਾਂ ਉਹਲੇ ਹੋ ਕੇ ਦੇਖਦੇ ਹਾਂ ਅਤੇ ਅਸੀਂ ਉਹਨੂੰ ਦੇਖਦੇ ਹਾਂ ਕਿ ਇਸ ਪੰਛੀ ਅਗਰ ਇਹ ਪੰਛੀ ਦੋ ਨਜ਼ਰ ਆਉਣ ਜਾਂ ਤਿੰਨ ਨਜ਼ਰ ਆਉਣ ਤਾਂ ਇਹਦੇ ਨਾਲ ਸਾਡਾ ਆਹ ਕੰਮ ਹੋ ਜਾਏਗਾ ਕੁਛ ਪੰਛੀਆਂ ਨੂੰ ਦੇਖਣ ਨਾਲ ਇਹ ਪਤਾ ਚਲਦਾ ਹੈ ਕਿ ਇਹ ਪੰਛੀ ਕਿਸ ਤਰ੍ਹਾਂ ਸਾਨੂੰ ਮਤਲਬ ਧਾਰਮਿਕ ਜਾਂ ਸਾਡੇ ਜਿੱਦਾਂ ਕੋਈ ਸਾਡੇ ਨਾਲ ਜੁੜੀ ਹੋਈ ਗੱਲਾਂ ਹੈਗੀਆਂ ਉਹਨਾਂ ਬਾਰੇ ਸਾਨੂੰ ਦੱਸਦਾ ਹੈ ਅਤੇ ਕਈ ਵਾਰ ਪੰਛੀ ਛੁਪ ਕੇ ਅਸੀਂ ਦੇਖਦੇ ਹਾਂ ਕਿ ਇਹ ਪੰਛੀ ਹੁਣ ਅਗਰ ਰੰਗ ਬਦਲੇਗਾ ਜਾਂ ਦੂਜੇ ਪਾਸੇ ਜਾਏਗਾ ਅਤੇ ਕੀ ਹੋਏਗਾ ਅਤੇ ਦੂਜੇ ਪਾਸੇ ਜਾਣ ਨਾਲ ਪੰਛੀਆਂ ਦਾ ਇਹ ਲੱਗਦਾ ਹੈ ਕਿ ਇਹ ਪੰਛੀ ਹੁਣ ਅਗਰ ਓਧਰ ਚਲਾ ਗਿਆ ਹੈ ਅਤੇ ਸਾਡਾ ਕੰਮ ਹੋ ਜਾਏਗਾ ਕਈ ਵਾਰ ਅਸੀਂ ਪੰਛੀਆਂ ਦੇ ਨਾਲ ਆਪਣੇ ਜੀਵਨ ਨੂੰ ਵੀ ਜੋੜ ਲੈਂਦੇ ਹਾਂ ਅਤੇ ਜੀਵਨ ਜੋੜਨਾ ਇੱਕ ਅੱਛੀ ਗੱਲ ਹੈ ਅਤੇ ਪੰਛੀ ਜਿਹੜੇ ਹੈਗੇ ਆ ਉਹ ਸਾਡੇ ਜ਼ਿੰਦਗੀ ਨਾਲ ਵੀ ਜੁੜੇ ਹੋਏ ਹਨ ਜ਼ਿੰਦਗੀ ਦੀਆਂ ਗੱਲਾਂ ਨਾਲ ਵੀ ਜੁੜੇ ਹੋਏ ਹਨ